ਅਸੀਂ ਪੇਂਡੂ ਖੇਤਰਾਂ 'ਚ ਜੇਕਰ ਗੱਲ ਕਰੀਏ ਨਿਊਜ਼ ਵਾਲਿਆਂ ਦੀ ਤਾਂ ਨਿਊਜ਼ ਵਾਲੇ ਮੇਨ ਚੀਜ਼ ਦਿਖਾਉਂਦੇ ਨੇ ਕਿ ਪਿੰਡ 'ਚ ਲੜਾਈ ਹੋ ਗਈ ਆਹ ਪਿੰਡ 'ਚ ਗੋਲੀ ਚੱਲ ਪਈ ਪਿੰਡ 'ਚ ਲੜਾਈ ਹੋ ਗਈ ਝਗੜਾ ਹੋ ਗਿਆ ਉਸਨੂੰ ਜੇਲ ਹੋ ਗਈ ਇਹ ਚੀਜ਼ਾਂ ਵਗੈਰਾ ਦਿਖਾਉਂਦੀ ਆ ਪਰ ਅਸਲ 'ਚ ਜੋ ਚੀਜ਼ਾਂ ਮੁੱਦੇ ਦਿਖਾਉਣੇ ਚਾਹੀਦੇ ਨੇ ਉਹ ਇਹ ਹਨ ਕਿ ਜਿਵੇਂ ਕਿ ਨਾਲੀਆਂ ਦਾ ਮਸਲਾ ਚਲਦਾ ਹੈ ਸੀਵਰੇਜ ਦਾ ਮਸਲਾ ਚਲਦਾ ਹੈ ਜਾਂ ਲਾਈਟਾਂ ਦਾ ਮਸਲਾ ਚਲਦਾ ਹੈ ਕਿ ਪਿੰਡਾਂ 'ਚ ਲਾਈਟਾਂ ਨਹੀਂ ਹੁੰਦੀਆਂ ਔਖਾ ਹੁੰਦਾ ਹੈ ਅਤੇ ਹੋਰ ਜਿਵੇਂ ਗਲੀਆਂ ਕੱਚੀਆਂ ਹੁੰਦੀਆਂ ਹੈ ਨਾ ਮੀਂਹ ਪੈਂਦਾ ਚਿੱਕੜ ਵਾ ਹੋ ਜਾਂਦਾ ਹੈ ਇਹ ਵਗੈਰਾ ਮਸਲੇ ਨਹੀਂ ਦਿਖਾਉਂਦੀਆਂ ਜੋ ਕਿ ਮੇਨ ਮਸਲੇ ਹਨ ਜੋ ਕਿ ਸਾਨੂੰ ਦਿਖਾਉਣੇ ਹ ਦਿਖਾਉਣੇ ਚਾਹੀਦੇ ਹਨ ਮੀਡੀਆ ਨੂੰ ਪਰ ਉਹ ਨਹੀਂ ਦਿਖਾਉਂਦੀ ਅਤੇ ਉਹ ਬੇਫਾਲਤੂ ਦੀ ਗੱਲਾਂ ਦਿਖਾਉਂਦੀ ਰਹਿੰਦੀ ਹੈ